ਧਰਮ ਲੋਕਾਂ ਨੂੰ ਇਕੱਠੇ ਰਹਿਣ ਵਿੱਚ ਕਾਫੀ ਅਹਿਮ ਭੂਮਿਕਾ ਨਿਭਾਉਂਦਾ ਹੈ ਜਿਵੇਂ ਕਿ ਆਪਾਂ ਗੱਲ ਕਰੀਏ ਭਾਈਚਾਰੇ ਅਤੇ ਧਾਰਮਿਕ ਤਿਉਹਾਰ ਦੀ ਬਹੁਤ ਸਾਰੇ ਲੋਕ ਇਕੱਠੇ ਹੋ ਕੇ ਸਲਾਹ ਕਰਦੇ ਨੇ ਅਤੇ ਫਿਰ ਉਸਨੂੰ ਮਨਾਉਣ ਬਾਰੇ ਸੋਚਦੇ ਹਨ ਉਸ ਵਿੱਚ ਕਾਫੀ ਯੋਗਦਾਨ ਵੀ ਪਾਉਂਦੇ ਹਨ ਪਹਿਲਾਂ ਸਭ ਤੋਂ ਪਹਿਲਾਂ ਸਲਾਹ ਕਰਕੇ ਉਸ ਨੂੰ ਤਿਉਹਾਰ ਨੂੰ ਮਨਾਇਆ ਜਾਂਦਾ ਹੈ ਗੁਰਦੁਆਰਾ ਸਾਹਿਬ ਵਿੱਚ ਇਕੱਠੇ ਹੋ ਕੇ ਇਸ ਦਾ ਵਰਣਨ ਕੀਤਾ ਜਾਂਦਾ ਹੈ ਜਿਵੇਂ ਕਿ ਆਪਾਂ ਗੱਲ ਕਰੀਏ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀ ਗੁਰਪੁਰਬ ਗੁਰਪੁਰਬ ਨੂੰ ਬਹੁਤ ਹੀ ਧੂਮ ਧਾਮ ਨਾਲ ਮਨਾਇਆ ਜਾਂਦਾ ਹੈ ਉਸ ਵਿੱਚ ਕਈ ਤਰ ਸੰਗਤਾਂ ਇਕੱਠੀਆਂ ਹੋ ਕੇ ਸਭ ਤੋਂ ਪਹਿਲਾਂ ਪਾਠ ਕਰਦੀਆਂ ਹਨ ਫਿਰ ਕੀਰਤਨ ਕੀਤਾ ਜਾਂਦਾ ਹੈ ਕੀਰਤਨ ਕਰਕੇ ਕੜਾਹ ਪ੍ਰਸ਼ਾਦ ਵਰਤਾਇਆ ਜਾਂਦਾ ਹੈ ਉਸ ਤੋਂ ਬਾਅਦ ਲੰਗਰ ਲੰਗਰ ਆਦਿ ਛਕਾਇਆ ਜਾਂਦਾ ਹੈ ਜਿਸ ਵਿੱਚ ਦਾਲ ਪ੍ਰਸ਼ਾਦਾ ਅਤੇ ਕਈ ਤਰ੍ਹਾਂ ਦੇ ਪਕਵਾਨ ਬਣਾਏ ਜਾਂਦੇ ਹਨ ਜੋ ਕਿ ਸੰਗਤ ਵਿੱਚ ਵਰਤਾਏ ਜਾਂਦੇ ਹਨ ਜੇ ਆਪਾਂ ਗੱਲ ਕਰੀਏ ਏ ਸੰਗਤ ਦੀ ਤਾਂ ਸੰਗਤ ਰਲ਼ ਮਿਲ ਕੇ ਇਕੱਠੀ ਇਸ ਤਿਉਹਾਰ ਨੂੰ ਮਨਾਉਂਦੀ ਹੈ